ਪੰਜਾਬੀ ਲੋਕ ਆਪਣੀਆਂ ਸੱਭਿਆਚਾਰਕ ਪਰ ਪਰੰਪਰਾਵਾਂ ਨੂੰ ਮਨਾਉਣ ਲਈ ਇਹ ਤਿਉਹਾਰ ਮਨਾਉਂਦੇ ਹਨ ਤਿਉਹਾਰਾਂ ਦੇ ਵਿੱਚ ਸੱਭਿਆਚਾਰ ਨੂੰ ਦਰਸਾਉਂਦੇ ਹਨ ਆਪ ਵੀ ਸੱਭਿਆਚਾਰਕ ਰੂਪ ਦੇ ਵਿੱਚ ਸਜਾਵਟ ਕਰਦੇ ਹਨ ਆਪਣੇ ਆਪਣਾ ਪਹਿਰਾਵਾ ਹਾਰ ਸ਼ਿੰਗਾਰ ਸੱਭਿਆਚਾਰਕ ਰੱਖਦੇ ਹਨ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਪਤਾ ਚੱਲੇ ਕਿ ਪੰਜਾਬ ਉਹਨਾਂ ਦਾ ਪੰਜਾਬੀ ਸੱਭਿਆਚਾਰ ਕੀ ਹੈ ਉਹ ਆਪਣੇ ਪੰਜਾਬੀ ਸੱਭਿਆਚਾਰ ਤੋਂ ਉਹਨਾਂ ਲੋਕਾਂ ਨੂੰ ਜਾਣੂ ਕਰਵਾਉਂਦੇ ਹਨ ਅਤੇ ਭਾਸ਼ਾ ਨੂੰ ਸਨਮਾਨ ਵੀ ਦਿੰਦੇ ਹਨ ਉਹਨਾਂ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਮਿੱਠਾ ਬੋਲਦੇ ਹਨ ਤਾਂ ਜੋ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਮਿਠਾਸ ਬਾਰੇ ਪਤਾ ਚੱਲੇ